ਮੇਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆ ਮੇਰੇ ਜ਼ਿਲ੍ਹੇ ਵਿੱਚ ਅਜਿਹੀਆਂ ਬਹੁਤ ਉਦਾਹਰਨਾਂ ਅਤੇ ਸਥਾਨ ਹਨ ਜਿੱਥੇ ਫਿਲਮਾਂ ਦੀਆਂ ਸ਼ੂਟਿੰਗਾਂ ਵਗੈਰਾ ਫੈਸ਼ਨ ਸ਼ੋਅ ਅਤੇ ਹੋਰ ਵੀ ਬਹੁਤ ਕੁਛ ਹੁੰਦਾ ਹੈ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਫਤਿਹਗੜ੍ਹ ਸਾਹਿਬ ਵਿੱਚ ਕੀ ਵਿਖੇ ਇੱਕ ਗੁਰਦੁਆਰਾ ਹੈ ਜਿੱਥੇ ਕਿ ਧਰਮਿਕ ਧਾਰਮਿਕ ਗਾਣਿਆਂ ਦੀਆਂ ਸ਼ੂਟਿੰਗਾਂ ਹੁੰਦੀਆਂ ਨੇ ਉਸ ਤੋਂ ਬਾਅਦ ਸਾਡੇ ਆਪਣੇ ਇੱਕ ਆਮ ਖਾਸ ਬਾਗ ਆ ਜਿੱਥੇ ਕਿ ਫਿਲਮਾਂ ਦੀਆਂ ਸ਼ੂਟਿੰਗਾਂ ਵਗੈਰਾ ਗਾਣਿਆਂ ਦੀਆਂ ਸ਼ੂਟਿੰਗਾਂ ਵਗੈਰਾ ਆਮ ਚੱਲਦੀਆਂ ਰਹਿੰਦੀਆਂ ਨੇ ਅਤੇ ਸਾਡੇ ਜ਼ਿਲ੍ਹੇ ਵਿੱਚ ਇੱਕ ਫਤਿਹ ਆਪਣੇ ਬਸੀ ਤਹਿਸੀਲ ਪੈਂਦੀ ਆ ਉੱਥੇ ਵੀ ਇੱਕ ਕਾਫੀ ਜਗ੍ਹਾ ਨੇ ਜਿੱਥੇ ਕਿ ਫਿਲਮਾਂ ਦੀਆਂ ਸ਼ੂਟਿੰਗਾਂ ਵਗੈਰਾ ਹੁੰਦੀਆਂ ਨੇ ਅਤੇ ਬਹੁਤ ਫਿਲਮਾਂ ਦੀਆਂ ਸ਼ੂਟਿੰਗਾਂ ਹੋਈਆਂ ਨੇ ਅਤੇ ਗਾਣਿਆਂ ਦੀਆਂ ਸ਼ੂਟਿੰਗਾਂ ਹੁੰਦੀਆਂ ਨੇ ਇੱਕ ਆ ਅਕਸ਼ੇ ਕੁਮਾਰ ਦੀ ਫਿਲਮ ਆਈ ਸੀ ਸਿੰਗ ਈਜ਼ ਬਲਿੰਗ ਉਹਦੀ ਫਿਲਮ ਦੀ ਵੀ ਸ਼ੂਟਿੰਗ ਬਸੀ ਪਠਾਣਾ ਹੀ ਹੋਈ ਆ ਅਤੇ ਆਪਣੇ ਇੱਕ ਇੱਕ ਮੈਕਡੋਨਲ ਆ ਉੱਥੇ ਨਾ ਉਹਦੇ ਵਿੱਚ ਅੰਦਰ ਫੈਸ਼ਨ ਸ਼ੋਅ ਵਗੈਰਾ ਦੇ ਉਹ ਚੱਲਦੇ ਨੇ ਬਣਿਆ ਹੋਇਆ ਫੈਸ਼ਨ ਸ਼ੋਅ ਵਗੈਰਾ ਦਾ ਉੱਥੇ ਫੈਸ਼ਨ ਸ਼ੋਅ ਵਗੈਰਾ ਬਹੁਤ ਹੁੰਦੇ ਨੇ